ਹੈਲੋ ਹਾਂਜੀ ਮੈਂ ਰੀਤਿਕਾ ਬੋਲ ਰਹੀ

ਹਾਂਜੀ ਯੋਗਾ ਦੇ ਬਾਰੇ ਦੇ ਵਿੱਚ ਤੁਹਾਨੂੰ ਇਹੀ ਕਹਾਂਗੀ ਯੋਗਾ ਸਭ ਤੋਂ ਵਧੀਆ ਯੋਗਾ ਸਾਡੇ ਲਈ ਤਾਂ ਤੁਸੀਂ ਮੰਨੋਗੇ ਕਿ ਇੱਕ ਦੇਣ ਇਹੋ ਜਿਹੀ ਭਗਵਾਨ ਦੀ ਕਿ ਜਿਹੜੀ ਅਸੀਂ ਇਸਤੇਮਾਲ ਕਰਕੇ ਅਸੀਂ ਬੜੇ ਬੜੇ ਬਿਮਾਰੀਆਂ ਦੂਰ ਕਰ ਸਕਦੇ ਹਾਂ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਜਾਂ ਤੁਸੀਂ ਸਟੂਡੈਂਟ ਹੋ ਹਾਂਜੀ ਹਾਂਜੀ ਤੁਸੀਂ ਯੋਗਾ ਦੇ ਵਿੱਚ ਹਾਂਜੀ ਯੋਗਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਟਾਈਮਿੰਗ ਮੇਰੀ ਹੈ ਤੁਸੀਂ ਪਹਿਲਾਂ ਤੁਹਾਨੂੰ ਇੱਥੇ ਆਉਣਾ ਪਏਗਾ ਯੋਗਾ ਸਿੱਖਣ ਦੇ ਲਈ ਯੋਗਾ ਦਾ ਤੁਸੀਂ ਇੱਕ ਘੰਟੇ ਦੀ ਹਾਂਜੀ ਮੈਂ ਨਾ ਬੱਤੀ ਏ ਮੈਡਿਕ ਇਨਕਏਵ ਤੋਂ ਬੋਲਦੀ ਹਾਂ ਮੇਰਾ ਆਪਣਾ ਇੱਥੇ ਹੀ ਆਪਣਾ ਦਫ਼ਤਰ ਹੈਗਾ ਵਾ ਅਤੇ ਘਰ ਦੇ ਕੋਲ ਹੀ ਅਤੇ ਇਸ ਕਰਕੇ ਤੁਹਾਨੂੰ ਪਹਿਲਾਂ ਇੱਥੇ ਹੀ ਆਉਣਾ ਪਵੇਗਾ ਅਤੇ ਇੱਥੇ ਆ ਕੇ ਤੁਸੀਂ ਦੋ ਦਿਨ ਪਹਿਲਾਂ ਸਿੱਖੋਗੇ ਚੰਗੀ ਤਰ੍ਹਾਂ ਯੋਗਾ ਫਿਰ ਉਸ ਤੋਂ ਬਾਅਦ ਤੁਸੀਂ ਕੀ ਘਰ ਕਰਨੀ ਚਾਹੁੰਦੇ ਹੋ ਤਾਂ ਘਰ ਕਰ ਲੈਣਾ ਅਤੇ ਕਿਤੇ ਬਾਹਰ ਕਰਨੀ ਚਾਹੁੰਦੇ ਹੋ ਤਾਂ ਬਾਹਰ ਕਰ ਸਕਦੇ ਹੋ ਅਤੇ ਸਾਡੇ ਕੋਲ ਇੱਥੇ ਆ ਕੇ ਵੀ ਕਰ ਸਕਦੇ ਹੈਗੇ ਹੋ ਯੋਗਾ ਵਿੱਚ ਤੁਸੀਂ ਬਹੁਤ

ਹਾਂ ਤੁਸੀਂ ਜਿੰਨੀ ਜਲਦੀ ਹੋ ਸਕਦਾ ਤੁਸੀਂ ਸਵੇਰੇ ਸਵੇਰੇ ਆ ਕੇ ਇੱਥੇ ਯੋਗਾ ਕਰ ਸਕਦੇ ਹੋ ਅਤੇ ਫਿਰ ਤੁਸੀਂ ਯੋਗਾ ਸਿੱਖ ਵੀ ਲਓ ਨਾਲ ਠੀਕ ਆ ਸਵੇਰੇ ਸਵੇਰੇ ਆਉਣਾ ਤਾਂ ਕੀ ਹਾਂਜੀ ਧੰਨਵਾਦ